ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਅੱਛਾ ਸਰ ਹਾਂਜੀ ਹਾਂਜੀ ਮੈਂ ਜਾਣਦੀ ਹਾਂ ਉਹਨਾਂ ਨੂੰ ਚੰਗੀ ਤਰ੍ਹਾਂ ਅੱਛਾ ਤੁਹਾਨੂੰ ਉਹਨਾਂ ਨੇ ਨੰਬਰ ਦਿੱਤਾ ਸੀਗਾ ਹਾਂਜੀ

ਹਾਂਜੀ ਹਾਂਜੀ ਸਾਡੇ ਇੱਥੇ ਨਾ ਆਰ ਟੀ ਓ ਦਾ ਆਫਿਸ ਹੈਗਾ ਹਾਂਜੀ ਅਤੇ ਉੱਥੋਂ ਮਤਲਬ ਔਫਿਸ 'ਚ ਜਾ ਕੇ ਉੱਥੋਂ ਰਜਿਸਟਰੇਸ਼ਨ ਦਾ ਫੋਰਮ ਮਿਲਦਾ ਇੱਕ ਤੁਸੀਂ ਉਹਨੂੰ ਫਿਲ ਕਰ ਲਿਓ ਅਤੇ ਬਾਕੀ ਜਿੰਨੇ ਵੀ ਮੇਨ ਡੋਕੂਮੈਂਟਸ ਹੋਣਗੇ ਹੈ ਨਾ ਤੇ ਉਹ ਉਹਦੇ ਨਾਲ ਲਗਾ ਕੇ ਅਤੇ ਉੱਥੇ ਦੇ ਆਫਿਸ 'ਚ ਸਬਮਿਟ ਕਰਵਾ ਦਿਓ ਇਹ ਤੁਸੀਂ ਔਨ ਔਫਲਾਈਨ ਹੀ ਕਰ ਸਕਦੇ ਹੋ ਪੇਮੈਂਟ ਤੁਸੀਂ ਇਕ ਵਾਰ ਕਨਫਰਮ ਕਰ ਲਿਓ ਉੱਥੋਂ ਵੈਸੇ ਤਾਂ ਪੁੱਛ ਲਿਓ ਘੱਟ ਹੀ ਲੱਗਦੇ ਆ ਸਰਕਾਰੀ ਆ ਅਤੇ ਬਾਕੀ ਇਕ ਵਾਰ ਕੰਨਫਰਮ ਕਰ ਲਿਓ ਤੁਸੀਂ ਪੇਮੈਂਟ ਦੀ ਉੱਥੇ ਜਾ ਕੇ ਹਾਂਜੀ ਅਤੇ ਬਾਕੀ ਦਸ ਪੰਦਰਾਂ ਦਿਨ ਤੱਕ ਜਿੰਨੇ ਵੀ ਦਿਨ ਲੱਗ ਜਾਣਗੇ ਤਾਂ ਤੁਹਾਡੇ ਘਰ ਹੀ ਪੁੱਜ ਜਾਏਗਾ ਹਾਂ ਵੈਸੇ ਇੰਨਾ ਟਾਈਮ ਨਹੀਂ ਲੱਗਦਾ ਥੋੜ੍ਹਾ ਹੀ ਟਾਈਮ ਲੱਗੂਗਾ ਹਾਂਜੀ ਬਾਕੀ ਤੁਸੀਂ ਉੱਥੇ ਜਾ ਕੇ ਕਰਵਾ ਲਿਓ ਫੋਮ ਲੈ ਕੇ ਹਾਂਜੀ ਹਾਂਜੀ ਓਕੇ ਕੋਈ ਨਾ ਜੀ ਹਾਂਜੀ ਠੀਕ ਆ